ਹੈਲੋ ਵੀਰ ਜੀ ਸਤ ਸ਼੍ਰੀ ਅਕਾਲ ਜੀ ਜੱਗੀ ਬਿਜਲੀ ਵਾਲਾ ਬੋਲਦੇ ਜੀ ਵੀਰ ਜੀ ਸਾਡੀ ਨਾ ਦੋ ਦਿਨਾਂ ਤੋਂ ਪਿਛਲੇ ਦੋ ਦਿਨਾਂ ਤੋਂ ਬਿਜਲੀ ਨਹੀਂ ਆ ਰਹੀ ਜੀ ਬਹੁਤ ਬੁਰਾ ਹਾਲ ਹੈ ਵੀਰੇ ਸਾਡਾ ਅਤੇ ਵੀਰ ਜੀ ਅਸੀਂ ਮੈਂ ਕਹਿੰਦੀ ਸੀ ਕਿ ਤੁਸੀਂ ਬਿਜਲੀ ਚੈੱਕ ਕਰ ਜਾਂਦੇ ਸਾਡੀ ਕਿ ਸਾਡਾ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਕੱਪੜਾ ਲੀੜਾ ਧੋਣ ਵਾਲਾ ਪਿਆ ਜੀ ਠੀਕ ਹੈ ਜੀ ਤੇ ਸਾਡਾ ਫਰਿੱਜ ਦਾ ਸਾਰਾ ਸਮਾਨ ਖ਼ਰਾਬ ਹੋਈ ਜਾਂਦਾ ਜੀ ਹਾਂਜੀ ਜੇ ਤੁਸੀਂ ਪਲੀਜ ਆ ਜਾਓ ਅੱਛਾ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਪਹੁੰਚ ਰਹੇ ਹੋ ਜੀ ਕਿਲ੍ਹਾ ਪੱਟੀ ਹੰਢਿਆਇਆ ਜੀ ਹਾਂਜੀ ਅਤੇ ਉਹ ਸਾਡੇ ਨਾ ਅਤੇ ਸਾਡੇ ਕੀ ਕਹਿੰਦੇ ਮੇਨ ਜੀ ਮੇਨ ਜਗ੍ਹਾ ਤੋਂ ਮੀਟਰ 'ਚੋ ਧੂੰਆਂ ਨਿਕਲਦਾ ਜੀ ਤਾਰਾਂ ਮੱਚ ਗਈਆਂ ਸੀਗੀਆਂ ਜੀ ਓੱਥੋਂ ਅਤੇ ਇਸ ਕਰਕੇ ਵੀਰ ਜੀ ਪਲੀਜ਼ ਥੋੜ੍ਹਾ ਜਿਹਾ ਜਲਦੀ ਆ ਜਾਇਓ ਜੀ ਹਾਂਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਕਾਫ਼ੀ ਨਿਕਲ ਰਿਹਾ ਜੀ ਕਾਫ਼ੀ ਤਾਰਾਂ ਵਿੱਚੋਂ ਮੱਚ ਗਈਆ ਜੀ ਦੋ ਤਿੰਨ ਤਾਰਾਂ ਵਿੱਚੋਂ ਮਤਲਬ ਕਿ ਧੂੰਆਂ ਨਿਕਲੀ ਜਾ ਰਿਹਾ ਜੀ ਨਹੀਂ ਜੀ ਵੀਰ ਜੀ ਬਸ ਉਹ ਮੇਨ ਉੱਥੋਂ ਨਿਕਲੀ ਜਾ ਰਿਹਾ ਜੀ ਹੋਰ ਤਾ ਕੋਈ ਪ੍ਰੋਬਲਮ ਨਹੀਂ ਜੀ ਅਤੇ ਇਸ ਕਰਕੇ ਮੈਂ ਕਹਿ ਰਹੀ ਸੀ ਥੋੜ੍ਹਾ ਜਿਹਾ ਮਾੜਾ ਜਿਹਾ ਜਲਦੀ ਆ ਜਾਇਓ ਜੀ ਠੀਕ ਹੈ ਜੀ ਵੀਰ ਜੀ ਹਾਂ ਠੀਕ ਹੈ ਧੰਨਵਾਦ ਵੀਰ ਜੀ